ਪੰਜਾਬ ਵਿੱਚ ਸਾਲ ਭਰ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਫਸਲਾਂ ਏ ਉਗਾਈਆਂ ਜਾਂਦੀਆਂ ਹਨ ਉਹਨਾਂ ਫਸਲਾਂ ਵਿੱਚ ਕਣਕ ਝੋਨਾ ਗੰਨਾ ਬਾਸਮਤੀ ਸਰ੍ਹੋਂ ਆਦਿ ਫਸਲਾਂ ਇਹ ਪੈਦਾ ਕੀਤੀਆਂ ਜਾਂਦੀਆਂ ਹਨ ਇਹ ਗਰਮੀ ਦੇ ਮੌਸਮ ਵਿੱਚ ਇਹ ਖ ਜ਼ਿਆਦਾਤਰ ਝੋਨਾ ਲਗਾਇਆ ਜਾਂਦਾ ਹੈ ਝੋਨੇ ਨੂੰ ਇਹ ਜਿਸ ਦੀ ਜ ਉਸ ਨੂੰ ਜ਼ਿਆਦਾ ਲੋੜ ਜ਼ਿਆਦਾ ਪਾਣੀ ਦੀ ਹੁੰਦੀ ਹੈ ਅਤੇ ਸਰਦੀਆਂ ਦੇ ਲ ਸਰਦੀਆਂ ਦੇ ਵਿੱਚ ਜ਼ਿਆਦਾਤਰ ਇਹ ਕਣਕ ਦੀ ਬਿਜਾਈ ਹੁੰਦੀ ਹੈ ਉਸ ਨੂੰ ਜ਼ਿਆਦਾ ਖੁਸ਼ਕੀ ਦੀ ਲੋੜ ਪੈਂਦੀ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੇ ਇਹ ਫਸਲਾਂ ਹਨ ਜਿਹਨਾਂ ਵਿੱਚੋਂ ਸਭ ਤੋਂ ਉੱਤੇ ਗੰਨਾ ਵੀ ਸਰਦੀਆਂ ਲਈ ਇਹ ਸਭ ਤੋਂ ਉੱਤੇ ਪੈਦਾਵਾਰ ਦਿੰਦਾ ਹੈ ਉਸ ਨੂੰ ਵੀ ਪਾਣੀ ਦੀ ਲੋੜ ਪੈਂਦੀ ਹੈ ਉਸ ਤੋਂ ਬਾਅਦ ਅ ਗਰਮੀਆਂ ਵਿੱਚ ਅ ਝੋਨੇ ਤੋਂ ਇਲਾਵਾ ਹੋਰ ਵੀ ਆਪਾਂ ਅ ਕਈ ਫਸਲਾਂ ਕਿਸਾਨ ਬੀਜਦੇ ਹਨ ਜੋ ਕਿ ਉਹਨਾਂ ਦੇ ਲਈ ਲਾਹੇਵੰਦ ਹਨ